ਕਿਸੇ ਵੀ ਤਰ੍ਹਾਂ ਦੀ ਸਰੀਰਕ ਐਕਟੀਵਿਟੀ ਜਾਂ ਦਿਮਾਗੀ ਐਕਟੀਵਿਟੀ ਸਾਡੇ ਸਰੀਰ ਅਤੇ ਦਿਮਾਗ ਦੋਨਾਂ ਵਾਸਤੇ ਹੀ ਹਰ ਪਾਸੋਂ ਮਦਦਗਾਰ ਹੁੰਦੀ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਅਗਰ ਅੱਗੇ ਤੱਕ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਸੁੰਦਰ ਕਾਇਆ ਦੀ ਬੜੀ ਹੀ ਜ਼ਰੂਰੀ ਹੈ ਅਤੇ ਸਾਡਾ ਸਰੀਰ ਸੁੰਦਰ ਉਸ ਇਸ ਤਰ੍ਹਾਂ ਰਹਿ ਸਕਦਾ ਹੈ ਕਿ ਅਸੀਂ ਆਪਣੇ ਸਰੀਰ ਨੂੰ ਹਮੇਸ਼ਾ ਕਿਸੇ ਨਾ ਕਿਸੇ ਕਸਰਤ ਦਾ ਦੇ ਸਾਥ ਦੇ ਨਾਲ ਅੱਗੇ ਲੈ ਕੇ ਜਾ ਸਕਦੇ ਹਾਂ ਅਤੇ ਜਿੱਥੋਂ ਤੱਕ ਗੱਲ ਹੈ ਭੰਗੜਾ ਐਰੋਬਿਕਸ ਦੀ ਤਾਂ ਬਿਲਕੁਲ ਇਹ ਮਾਨਸਿਕ ਸਿਹਤ ਦੇ ਨਾਲ ਨਾਲ ਭਾਵਨਾਤਮਕ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕਰਦਾ ਹੈ ਜਿਵੇਂ ਕਿ ਅਗਰ ਮੈਂ ਆਪਣੀ ਇੱਕ ਪਰਸਨਲ ਆਪਣੀ ਨਿੱਜੀ ਉਦਾਹਰਨ ਦੇਣਾ ਚਾਹਵਾਂ ਤਾਂ ਮੈਨੂੰ ਕੁਛ ਸਮਾਂ ਪਹਿਲਾਂ ਗਠੀਏ ਦੀ ਬਿਮਾਰੀ ਸੀ ਗਠੀਏ ਦੀ ਬਿਮਾਰੀ ਮੈਨੂੰ ਚਿਕਨਗੁਨੀਆ ਤੋਂ ਹੋਈ ਲੇਕਿਨ ਮੈਂ ਉਹਦੀ ਇੱਕ ਸਾਲ ਦਵਾਈ ਵੀ ਖਾਧੀ ਐਲੋਪੈਥਿਕ ਦਵਾਈ ਸੀ ਜਿਵੇਂ ਖਾਂਦੀ ਸੀ ਬਸ ਉੰਨੀ ਜਲਦੀ ਹੀ ਠੀਕ ਹੋ ਜਾਂਦੀ ਸੀ ਪਰ ਲੰਬੇ ਅਰਸੇ ਵਾਸਤੇ ਮੈਂ ਦਵਾਈ ਮੈਨੂੰ ਖਾਣੀ ਪੈ ਰਹੀ ਸੀ ਤੇ ਮੈਂ ਇੱਕ ਯੋਗਾ ਕਲਾਸਿਸ ਜੁਆਇਨ ਕੀਤੀਆਂ ਜਿਹਦੇ ਵਿੱਚ ਮੈਨੂੰ ਉਹਨੇ ਕਿਹਾ ਕਿ ਤੁਸੀਂ ਆਪਣੀ ਸਰੀਰ ਨੂੰ ਜਿੰਨਾ ਵੀ ਹਿਲਜੁਲ ਵਿੱਚ ਰੱਖੋਗੇ ਜਿੰਨਾ ਵੀ ਇਹਨੂੰ ਕੰਮ 'ਚ ਰੱਖੋਗੇ ਤਾਂ ਤੁਸੀਂ ਤੰਦਰੁਸਤ ਹੋ ਸਕੋਗੇ ਅਤੇ ਮੈਂ ਆਪਣੇ ਸਰੀਰ ਨੂੰ ਭੰਗੜੇ ਦੇ ਰਾਹੀਂ ਤੰਦਰੁਸਤ ਬਣਾਇਆ ਔਰ ਅੱਜ ਮੈਂ ਬਿਲਕੁਲ ਹੀ ਗਠੀਆ ਮੁਕਤ ਹਾਂ ਤੋ ਮੇਰੇ ਅਨੁਸਾਰ ਬਿਲਕੁਲ ਭੰਗੜਾ ਐਰੋਬਿਕਸ ਨੂੰ ਮਾਨਸਿਕ ਸਿਹਤ ਵੀ ਸਾਡੀ ਸਹੀ ਰਹਿੰਦੀ ਹੈ ਅਤੇ ਸਾਨੂੰ ਸਰੀਰਕ ਤੰਦਰੁਸਤੀ ਵੀ ਬਹੁਤ ਵਧੀਆ ਤਰੀਕੇ ਨਾਲ ਸਾਡਾ ਸਰੀਰ ਚੱਲੇਗਾ ਅਤੇ ਅਸੀਂ ਆਪਣੀ ਜ਼ਿੰਦਗੀ ਨੂੰ ਬੜੇ ਸੋਹਣੇ ਤਰੀਕੇ ਨਾਲ ਜੀਅ ਸਕਦੇ ਹਾਂ ਧੰਨਵਾਦ